ਮੈਂ ਇੱਕ ਸਿੰਪਲ ਜਿਹੇ ਪਿੰਡ ਤੋਂ ਹਾਂ ਮੈਨੂੰ ਪਿੰਡ ਬਹੁਤ ਚੰਗੇ ਲੱਗਦਾ ਮੈਨੂੰ ਪਿੰਡਾਂ ਦੀ ਜਾਣਕਾਰੀ ਬਾਰੇ ਬਹੁਤ ਕੁਝ ਪਤਾ ਹੈ ਮੇਰੇ ਦਾਦਾ ਅਤੇ ਦਾਦੀ ਜੀ ਨੇ ਪਸ਼ੂ ਪਾਲੇ ਹੋਏ ਸਨ ਮੈਨੂੰ ਜਿੱਦਾਂ ਜਿੱਦਾਂ ਮੇਰੇ ਦਾਦਾ ਦਾਦੀ ਸੀ ਕੱਢਦੇ ਹੁੰਦੇ ਸਨ ਮੈਂ ਦੇਖਦੀ ਰਹਿੰਦੀ ਹੁੰਦੀ ਸੀ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਕਿੱਦਾਂ ਕਿੱਦਾਂ ਕੱਢਦੇ ਹਨ ਪ੍ਰਸ਼ਾਸਨ ਲਈ ਤੁਸੀਂ ਕੀ ਪ੍ਰਸ਼ਾਸਨ ਲਈ ਤੁਸੀਂ ਇੱਕ ਦੀ ਸਲਾਹ ਲੈਂਦੇ ਹੋ ਕਿ ਜੀ ਨਹੀਂ ਮੈਂ ਯੂਟੀਊਬ ਚੈਨਲ ਦੇਖਦੀ ਹਾਂ ਉੱਥੇ ਮੈਨੂੰ ਪਤਾ ਲੱਗਦਾ ਹੈ ਕਿ ਕਿੱਦਾਂ ਕਿਦਾਂ ਪਸ਼ੂ ਹੋਇਆ ਕਿੱਦਾਂ ਕਿੱਦਾਂ ਦਾ ਕਿੰਨਾ ਕ ਮੈਂ ਅਖਬਾਰ ਵੀ ਪੜ੍ਹਦੀ ਹਾਂ ਅਖਬਾਰ ਤੋਂ ਬਹੁਤ ਕੁਝ ਮਿਲਦਾ ਹੈ ਕਿ ਕੀ ਕਰਨਾ ਚਾਹੀਦਾ ਕੀ ਨਹੀਂ ਚਾਹੀਦਾ ਵੈਸੇ ਤਾਂ ਮੈਂ ਆਪਣੇ ਦਾਦਾ ਦਾਦੀ ਤੋਂ ਪੁੱਛ ਲੈਂਦੀ ਹਾਂ ਕਿ ਉਹ ਜਦੋਂ ਬਿਮਾਰ ਹੋਣ ਉਹਨੂੰ ਕੀ ਕਰਨਾ ਚਾਹੀਦਾ ਹੈ ਕੀ ਦੇਣਾ ਚਾਹੀਦਾ ਹੈ ਜੋ ਕਿ ਠੀਕ ਹੋ ਜਾਣ ਜੇ ਨਾ ਠੀਕ ਹੋਣ ਤਾਂ ਫਿਰ ਸਾਨੂੰ ਡਾਕਟਰ ਉਹ ਵੀ ਦਿਖਾਉਣਾ ਚਾਹੀਦਾ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਮੈਂ ਕਿਤਾਬਾਂ ਵੀ ਪੜ੍ਹਦੀ ਹਾਂ ਜਿਸ ਤੋਂ ਮੈਨੂੰ ਬਹੁਤ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਪਸ਼ੂ ਪਾਲਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਇਹਨਾਂ ਨੂੰ ਬੱਚਿਆਂ ਦੇ ਵਾਂਗ ਹੀ ਸਾਂਭਣਾ ਪੈਂਦਾ ਹੈ ਇਹਨਾਂ ਦੀ ਕੇਅਰ ਕਰਨੀ ਪੈਂਦੀ ਹੈ ਇਹਨਾਂ ਨੂੰ ਸਾਰਾ ਟਾਈਮ ਸਿਰ ਖਾਣਾ ਚਾਹੀਦਾ ਪਾਣੀ ਵੀ ਪਿਆਉਣਾ ਚਾਹੀਦਾ ਤਾਂ ਕਿ ਜੋ ਪਿਆਸ ਨਾ ਮਰ ਨਾ ਜਾਣ ਇਹਨਾਂ ਦੀ ਇਹਨਾਂ ਦੀ ਦੇਖਭਾਲ ਕਰਨਾ ਸਾਡੇ ਇੱਕ ਬਹੁਤ ਵੱਡੇ ਜੋ ਜ਼ਿੰਮੇਵਾਰੀ ਹੈ ਇ ਇੱਕ ਯੂਟੀਊਬ ਚੈਨਲ ਵੀ ਮੈਂ ਦੇਖਦੀ ਜਿੱਥੋਂ ਪਤਾ ਲੱਗਦਾ ਹੈ ਕਿ ਜਾਨਵਰਾਂ ਦੇ ਦੇਖ ਰੇਖ ਕਿਵੇਂ ਕੀਤੀ ਜਾਂਦੀ ਹੈ ਮੈਂ ਇਹ ਸਭ ਕੁਝ ਦੇਖਦੀ ਰਹਿੰਦੀ ਹਾਂ ਕੀ ਜਾਨਵਰਾਂ ਦੀ ਦੇਖ ਰੇਖ ਕਿਵੇਂ ਹੁੰਦੀ ਹੈ